ਕੱਲ੍ਹ ਮੈਂ ਫਰੀ ਬੈਠਾ ਬੈਠਾ ਇੱਕ ਡਰਾਇੰਗ ਬਣਾ ਰਿਹਾ ਸੀ ਡਰਾਇੰਗ ਵਿੱਚ ਮੈਂ ਗਲੋਬਲ ਵਾਰਮਿੰਗ ਦਾ ਜੋ ਪੂਰਾ ਡਾਇਗਰਾਮ ਆ ਉਹ ਬਣਾ ਲਿਆ ਸੀ ਬਣਾਉਂਦੇ ਬਣਾਉਂਦੇ ਜਦੋਂ ਮੇਰਾ ਪੂਰਾ ਡਾਇਗਰਾਮ ਕੰਪਲੀਟ ਹੋ ਗਿਆ ਉਹਦੇ ਵਿੱਚ ਮੈਂ ਪੂਰੇ ਗਲੋਬਲ ਵਾਰਮਿੰਗ ਦੇ ਜੋ ਕਿ ਕਿਆ ਦੁਸ਼ਟ ਪ੍ਰਭਾਵ ਸਾਰਾ ਕੁਛ ਉਹਦੇ ਵਿੱਚ ਸ਼ੋਅ ਕੀਤਾ ਤਾਂ ਬਣਾਉਣ ਤੋਂ ਬਾਅਦ ਮੈਨੂੰ ਮੇਰਾ ਦੋਸਤ ਮੇਰੇ ਘਰ ਆਇਆ ਤਾਂ ਉਸ ਨੇ ਜਦੋਂ ਦੇਖਿਆ ਤਾਂ ਉਸਨੂੰ ਇਸ ਬਾਰੇ ਕੁਛ ਪਤਾ ਨਹੀਂ ਸੀ ਗਲੋਬਲ ਵਾਰਮਿੰਗ ਹੁੰਦੀ ਕੀ ਹੈ ਜਦੋਂ ਉਸਨੇ ਇਸਨੂੰ ਦੇਖਿਆ ਤਾਂ ਉਹ ਹੈਰਾਨ ਹੋ ਗਿਆ ਉਸ ਮੇਰੇ ਉਹ ਤੋਂ ਪੁੱਛਣ ਲੱਗ ਗਿਆ ਗਲੋਬਲ ਵਾਰਮਿੰਗ ਬਾਰੇ ਤਾਂ ਜਦੋਂ ਉਸਨੂੰ ਮੈਂ ਗਲੋਬਲ ਵਾਰਮਿੰਗ ਦੇ ਪੂਰਾ ਪ੍ਰਭਾਵ ਦੱਸਿਆ ਕਿ ਗਲੋਬੋ ਵਾਰਮਿੰਗ 'ਚ ਵਿੱਚ ਹੁੰਦਾ ਕੀ ਹੈ ਕਿ ਕਿਵੇਂ ਜਿਹੜੀਆਂ ਗੈਸਾਂ ਉਹ ਉੱਪਰ ਜਾ ਕੇ ਜੋ ਕਿ ਬਹੁਤ ਜ਼ਿਆਦਾ ਗਰਮੀ ਕਰ ਰਹੀਆਂ ਜਿਸ ਕਾਰਣ ਸਾਡੇ ਗਲੇਸ਼ੀਅਰ ਜੋ ਪਿਘਲਣੇ ਸ਼ੁਰੂ ਹੋ ਗਏ ਹਨ ਤਾਂ ਉਹ ਇਸ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੋ ਗਿਆ ਤਾਂ ਉਹ ਕਹਿਣ ਲੱਗਿਆ ਵੀ ਬਾਈ ਤੂੰ ਤਾਂ ਬਹੁਤ ਵਧੀਆ ਚੀਜ਼ ਬਣਾਈ ਹੈ ਜੇਕਰ ਆਪਾਂ ਇਹਦੇ ਬਾਰੇ ਪ੍ਰਚਾਰ ਕਰਨਾ ਸ਼ੁਰੂ ਕਰ ਦੇਈਏ ਲੋਕਾਂ ਨੂੰ ਆਪਾਂ ਇਹ ਚੀਜ਼ ਕਹਿਣ ਲੱਗ ਜਾਈਏ ਕਿ ਤੁਸੀਂ ਗਲੋਬਲ ਵਾਰਮਿੰਗ ਨੂੰ ਘਟਾਉਣ ਲਈ ਕੀ ਕੀ ਕਰ ਸਕਦੇ ਹੋ ਤਾਂ ਆਪਣੇ ਗਲੋਬਲ ਵਾਰਮਿੰਗ ਵਿੱਚ ਬਹੁਤ ਜ਼ਿਆਦਾ ਫ਼ਰਕ ਪੈ ਸਕਦਾ ਹੈ ਆਪਣੇ ਇੱਕ ਕਦਮ ਨਾਲ ਕਈ ਲੋਕ ਜੋ ਆਪਣੇ ਕੰਮ ਆ ਉਹ ਸੌਖੇ ਕਰ ਸਕਦੇ ਹਨ ਤਾਂ ਕਹਿ ਸਕਦੇ ਹਾਂ ਕਿ ਗਲੋਬਲ ਵਾਰਮਿੰਗ ਉੱਤੇ ਪੂਰਾ ਜ਼ਿਆਦਾ ਅਸੀਂ ਕੰਟਰੋਲ ਆਪਣਾ ਸ਼ੁਰੂ ਕਰ ਸਕਦੇ ਹਾਂ ਇੱਕ ਛੋਟੇ ਜਿਹੇ ਕਦਮ ਤੋਂ ਅਤੇ ਮੇਰੇ ਇੱਕ ਛੋਟੇ ਜਿਹੇ ਇਸ ਆਰਟ ਨੇ ਮੇਰੇ ਦੋਸਤ ਦੀਆਂ ਜੋ ਅੱਖਾਂ ਖੋਲ ਦਿੱਤੀਆਂ ਅਤੇ ਉਹ ਉਹਨੇ ਕਦਮ ਸ਼ੁਰੂ ਕਰ ਦਿੱਤਾ ਅਤੇ ਉਹ ਆਪ ਤਾਂ ਉਹ ਆਗਾਹ ਹੋਇਆ ਹੀ ਹੋਇਆ ਉਹ ਅੱਗੇ ਤੋਂ ਅੱਗੇ ਆਪਣੇ ਹੋਰ ਦੋਸਤਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੇ ਰਿਸ਼ਤੇਦਾਰਾਂ ਵਿੱਚ ਇਹ ਸੰਕੇਤ ਦੇਣ ਲੱਗ ਗਿਆ ਗਲੋਬਲ ਵਾਰਮਿੰਗ ਕੀ ਹੁੰਦੀ ਹੈ ਅਤੇ ਉਸਨੇ ਮੇਰਾ ਵੀ ਉਸ ਵਿੱਚ ਜ਼ਿਕਰ ਕੀਤਾ ਕਿ ਮੇਰੇ ਦੋਸਤ ਨੇ ਕਿਵੇਂ ਇੱਕ ਇੱਕ ਛੋਟੀ ਜਿਹੀ ਡਰਾਇੰਗ ਦੇ ਦੁਆਰਾ ਮੈਨੂੰ ਇਹ ਸਭ ਸਮਝਾ ਦਿੱਤਾ ਕਿ ਗਲੋਬਲ ਵਾਰਮਿੰਗ ਸਾਡੇ ਲਈ ਕਿੰਨੀ ਖ਼ਤਰਨਾਕ ਹੈ ਕਹਿੰਦੇ ਤਾਂ ਇਹ ਹੀ ਹੈ ਕਿ ਗਲੋਬਲ ਵਾਰਮਿੰਗ ਸਾਨੂੰ ਪਤਾ ਕਿ ਸਾਡੇ ਲਈ ਕਿੰਨੀ ਖ਼ਤਰਨਾਕ ਹੈ ਗਲੋਬਲ ਵਾਰਮਿੰਗ ਦੀ ਕਾਰਣ ਹੀ ਸਾਡੇ ਜੋ ਗਲੇਸ਼ੀਅਰ ਇਹਨਾਂ ਨੂੰ ਪਿਘਲਣੇ ਸ਼ੁਰੂ ਹੋ ਗਏ ਹਨ ਇੱਕ ਦਿਨ ਅਜਿਹਾ ਦੂਰ ਨਹੀਂ ਕਿ ਜਿਸ ਦਿਨ ਸਾਡੀ ਪੂਰੀ ਜੋ ਧਰਤੀ ਹੈ ਉਹਦੇ ਉੱਤੇ ਪਾਣੀ ਆ ਜਾਵੇਗਾ ਅਤੇ ਸਾਡੀ ਧਰਤੀ ਡੁੱਬ ਜਾਵੇਗੀ ਇਹਨਾਂ ਗਲੋਬਲ ਵਾਰਮਿੰਗ ਦੇ ਕਾਰਣ ਮੈਨੂੰ ਇਹ ਹੀ ਲੱਗਦਾ ਕਿ ਮੇਰੀ ਇਸ ਛੋਟੀ ਜਿਹੀ ਜੋ ਚੀਜ਼ ਨੇ ਛੋਟੀ ਜਿਹੀ ਡਰਾਇੰਗ ਨੇ ਇਹਦੇ ਵਿੱਚ ਇੱਕ ਡੂੰਘਾ ਅਰਥ ਕੱਢਿਆ ਇੱਕ ਡੂੰਘਾ ਮਹੱਤਵ ਕੱਢਿਆ ਅਤੇ ਜਿਹਦੇ ਕਾਰਣ ਮੇਰਾ ਦੋਸਤ ਹੈ ਉਸਨੂੰ ਇੰਨੀ ਵਧੀਆ ਗਿਆਨ ਦੀ ਪ੍ਰਾਪਤੀ ਹੋਈ ਅਤੇ ਉਸ ਨੂੰ ਗਲੋਬਲ ਵਾਰਮਿੰਗ ਦੇ ਬਾਰੇ ਜਾਣਕਾਰੀ ਮਿਲੀ ਅਤੇ ਉਸਨੇ ਵੀ ਆਪਣੇ ਪੂਰੇ ਪਰਿਵਾਰ ਅਤੇ ਪੂਰੇ ਦੋਸਤਾਂ ਦੇ ਵਿੱਚ ਇਸ ਦੇ ਬਾਰੇ ਜ਼ਿਕਰ ਕੀਤਾ ਅਤੇ ਉਸ ਨਾਲ ਗਲੋਬਲ ਵਾਰਮਿੰਗ ਵਿੱਚ ਤਾਂ ਥੋੜ੍ਹਾ ਘਾਟਾ ਹੋਵੇਗਾ ਕਿ ਮਤਲਬ ਗਲੋਬਲ ਵਾਰਮਿੰਗ ਕੰਟਰੋਲ ਤਾਂ ਹੋਵੇਗੀ ਚਲੋ ਥੋੜ੍ਹੀ ਹੋਵੇਗੀ ਪਰ ਸਾਡੇ ਛੋਟਾ ਜਿਹਾ ਕਦਮ ਬਹੁਤ ਸਾਰੇ ਲੋਕਾਂ ਨੂੰ ਇੱਕ ਛੋਟਾ ਜਿਹਾ ਸੰਕੇਤ ਜ਼ਰੂਰ ਦੇਵੇਗਾ